ਅੱਜ ਦੇ ਟਾਈਮ ਵਿੱਚ ਬਹੁਤ ਹੀ ਰਿਚਾਰਜ ਮਹਿੰਗੇ ਹੋ ਗਏ ਨੇ ਤੇ ਇਨਕਮ ਸੈਲਰੀ ਬਹੁਤ ਘੱਟ ਹੈ ਇਸ ਕਰਕੇ ਇਸ ਕਰਕੇ ਮੇਰੇ ਕੋਲ ਕੁਛ ਵੀ ਆਮਦਨ ਨਹੀਂ ਬਚਦੀ ਹੈ ਕਿਉਂਕਿ ਰੀਚਾਰਜ ਰਿਚਾਰਜ ਦੀ ਇਨਕਮ ਜੋ ਹੈ ਉਹ ਬਹੁਤ ਜਿਆਦਾ ਹੈ ਤੇ ਇਹ ਰਿਚਾਰਜ ਹਰੇਕ ਮਹੀਨੇ ਕਰਵਾਉਣਾ ਪੈਂਦਾ ਹੈ ਇਸ ਕਰਕੇ ਮੈਂ ਚਾਹੁੰਦੀ ਆਂ ਕਿ ਕੁਝ ਖਰਚੇ ਮੈਂ ਘੱਟ ਕਰਾਂ ਤੇ ਉਹ ਰੀਚਾਰਜ ਵੀ ਉਹਨਾਂ ਵਿੱਚ ਹੀ ਆਂਦਾ ਹੈ ਮੈਂ ਇਹ ਜਿਹੜੇ ਖਰਚੇ ਹਨ ਉਹ ਘਟਾ ਕੇ ਤੇ ਮੈਂ ਚਾਹੁੰਦੀ ਹਾਂ ਕਿ ਮੇਰੇ ਕੋਲ ਵੀ ਕੁਝ ਆਮਦਨ ਬਚ ਸਕੇ ਤਾਂ ਕਰਕੇ ਮੈਨੂੰ ਪਤਾ ਹੈ ਕਿ ਮੈਂ ਕਰ ਦੂਗੀ ਮੈਂ ਰਿਚਾਰਜ ਜੇ ਮੈਂ ਰੀਚਾਰਜ ਦੇ ਖਰਚੇ ਨਾ ਕਰਾਂ ਤਾਂ ਤਾਂ ਮੇਰੇ ਕੋਲ ਥੋੜੀ ਬਹੁਤੀ ਤਾਂ ਇਨਕਮ ਬਚ ਸਕਦੀ ਹੈ